ਸਾਡੇ ਧਰਮ ਵਿੱਚ ਪਾਠ ਦਾ ਤਾਂ ਬਹੁਤ ਸਕੂਲਾਂ ਵਿੱਚ ਜੋ ਵੀ ਪਾਠ ਪੜ੍ਹਾਇਆ ਜਾਂਦਾ ਨਾ ਉਸ ਵਿੱਚ ਸਿੱਖ ਧਰਮ ਬਾਰੇ ਸਿਲੇਬਸ ਹੈਗਾ ਸਿੱਖ ਧਰਮ ਦਾ ਇਤਿਹਾਸ ਦੱਸਿਆ ਜਾਂਦਾ ਬੱਚਿਆਂ ਨੂੰ ਕਿਵੇਂ ਜੰਗ ਯੁੱਧ ਹੋਏ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਰੀਆਂ ਆਪਣੇ ਜੀਵਨ ਵਿੱਚ ਅਤੇ ਸਾਡਾ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਇਨ੍ਹਾਂ ਦਾ ਹੀ ਦੇਣ ਹੈਗੀ ਆ ਗੁਰੂਆਂ ਦੀ ਸਾਰੇ ਆਪਣਾ